ਹੈਲੋ ਹਾਂਜੀ ਮੈਂ ਦੀਪਕ ਬਾਸੂ ਬੋਲਿਆ ਕਰਨਾ ਜੀ ਅਤੇ ਮੈਂ ਉਹ ਇੱਥੇ ਗੁਰਦਾਸਪੁਰ ਆਇਆ ਨਵਾਂ ਅਤੇ ਇੱਥੇ ਸਬਜ਼ੀ ਸੁਬਜ਼ੀ ਕਿੱਥੋਂ ਮਿਲਦੀ ਤਾਜ਼ੀਆਂ ਮੈਨੂੰ ਉਹ ਪਤਾ ਨਹੀਂ ਹੈਗਾ ਇੱਥੇ ਤਾਜ਼ੀ ਸਬਜ਼ੀਆਂ ਕਿੱਥੋਂ ਮਿਲਦੀਆਂ ਅਤੇ ਬੜੀ ਪਰੇਸ਼ਾਨੀ ਆਉਂਦੀ ਪਈ ਆ ਅੱਛਾ ਜੀ ਇਹਦਾ ਰੇਟ ਮੈਂ ਸੁਣਿਆ ਕਹਿੰਦੇ ਰੇਟ ਵੱਧ ਹੁੰਦਾ ਇਹਦਾ ਨਹੀਂ ਸ ਸਸਤੀ ਵੀ ਹੋਣੀ ਚਾਹੀਦੀ ਆ ਸਸਤੀ ਇੱਥੇ ਮੰਡੀ ਮੰਡੀ ਮੁੰਡੀ ਕਿੱਥੇ ਲੱਗਦੀ ਹੈ ਇੱਥੇ

ਠੀਕ ਚਲੋ ਠੀਕ ਹੈ ਜੀ ਠੀਕ ਹੈ ਜੀ ਮਿਹਰਬਾਨੀ